ਹੈਲੋ ਸਤਿ ਸ਼੍ਰੀ ਅਕਾਲ ਸਰ ਤੁਸੀਂ ਅਕਾਲ ਅਕੈਡਮੀ ਤੋਂ ਬੋਲ ਰਹੇ ਹੋ ਅਤੇ ਮੇਰੀ ਗੁੜੀਆ ਤਨਵੀਰ ਕੌਰ ਨੂੰ ਛੁੱਟੀ ਚਾਹੀਦੀ ਹੈ ਦਸ ਦਿਨ ਦੀ ਅਸੀਂ ਕਿਤੇ ਵਿਆਹ ਜਾਣਾ ਵਾ ਦੂਰ ਹੀ ਹਾਂਜੀ ਸਰ ਨਹੀਂ ਹਾਨੂੰ ਜ਼ਰੂਰੀ ਆ ਫਿਰ ਜਾਣਾ ਪੈਣਾ ਵਾ ਦਸ ਕ ਦਿਨ ਦੀ ਛੁੱਟੀ ਚਾਹੀਦੀ ਆ ਰਿਕੁਐਸਟ ਹੀ ਆ ਸਰ ਵੀ ਕੋਈ ਨਹੀਂ ਅਸੀਂ ਜਿਹੜਾ ਹੋਮਵਰਕ ਦੇ ਦਿਓ ਤੁਸੀਂ ਅਸੀਂ ਇਹਨੂੰ ਘਰੇ ਕਰਵਾ ਲਿਆ ਕਰਾਂਗੇ ਅਤੇ ਥੋੜ੍ਹੇ ਕੁ ਦਿਨ ਦੀ ਛੁੱਟੀ ਦਸ ਕੁ ਦਿਨ ਦੀ ਛੁੱਟੀ ਕਰ ਦਿਓ ਸਰ ਚਲੋ ਕੋਈ ਨਹੀਂ ਸਰ ਅਜੈਸਟ ਕਰ ਲਉ ਦੇ ਦੋ ਬਾਕੀ ਸਕੂਲ ਦਾ ਹੋਮਵਰਕ ਵਗੈਰਾ 'ਚ ਘਰ ਕਰਵਾ ਲਾਂਗੇ ਨਾਲੋ ਨਾਲ ਚਲੋ ਓਕੇ ਸਰ ਚਲੋ ਠੀਕ ਹੈ ਸਰ